ਪੰਜਾਬ ਦੇ ਹਿਮਾਇਲੀ ਆਈ ਖੇਤਰ ਦੇ ਨੇੜੇ ਆਪਣਾ ਜਿਹੜਾ ਮਹੱਤਵਪੂਰਨ ਯਾਤਰਾ ਸਥਲ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਆ ਉਥੇ ਵੱਡੀ ਗਿਣਤੀ ਵਿੱਚ ਸੰਗਤਾਂ ਜਾਂਦੀਆਂ ਦਰਸ਼ਨ ਕਰਨ ਲਈ ਹੁਣੇ ਪਿਛਲੇ ਦਿਨਾਂ ਚ ਉੱਥੇ ਹੋਲੇ ਮਹੱਲੇ ਦਾ ਤਿਹਾਰ ਮਨਾਇਆ ਗਿਆ ਜਿਸ ਵਿੱਚ ਦੇਸ਼ ਦੇ ਸਾਰੇ ਹੋਰ ਸਟੇਟਾਂ ਵਿੱਚੋਂ ਕੋਣੇ ਕੋਣੇ ਚੋਂ ਸੰਗਤਾਂ ਆਈਆਂ ਉੱਥੇ ਆ ਕੇ ਉਹਨਾਂ ਨੇ ਹਾਜਰੀ ਲਵਾਈ ਆਪਣੀ ਹੋਲੇ ਮਹੱਲੇ ਤੋਂ ਇਲਾਵਾ ਵੀ ਵੈਸੇ ਵੀ ਆਮ ਤੌਰ ਤੇ ਰੂਟੀਨ 'ਚ ਵੀ ਲੋਕ ਉਥੇ ਦਰਸ਼ਨ ਕਰਨ ਲਈ ਜਾਂਦੇ ਹਨ ਤੇ ਇਸ ਦੇ ਨਾਲ ਹੀ ਇਹ ਉਸ ਪਹਾੜਾਂ ਦੇ ਨੇੜੇ ਹੋਣ ਕਰਕੇ ਇਥੇ ਮੌਸਮ ਵੀ ਠੀਕ ਰਹਿੰਦਾ ਹੈ ਜਿਆਦਾ ਗਰਮੀ ਨਹੀਂ ਹੁੰਦੀ ਜਿਵੇਂ ਕਿ ਹਿਮਾਚਲ 'ਚ ਜਿਆਦਾਤਰ ਠੰਡ ਹੀ ਰਹਿੰਦੀ ਹੈ ਗਰਮੀ ਥੋੜੇ ਸਮੇਂ ਲਈ ਹੁੰਦੀ ਹੈ ਉਸੇ ਤਰ੍ਹਾਂ ਇਹ ਨੇੜੇ ਹੋਣ ਕਰਕੇ ਇੱਥੇ ਵੀ ਗਰਮੀ ਥੋੜੀ ਘੱਟ ਰਹਿੰਦੀ ਹੈ ਇਸ ਤੋਂ ਇਲਾਵਾ ਇਧਰਲੇ ਪਾਸੇ ਆਪਣਾ ਪਠਾਨਕੋਟ ਦੇ ਵਾਲੇ ਪਾਸੇ ਉਧਰ ਵੀ ਗੁਰਦੁਆਰਾ ਸਾਹਿਬ ਹਨ ਯਾਤਰਾ ਸਥਲ ਹਨ ਉਥੇ ਵੀ ਉਧਰਲੇ ਪਾਸੇ ਨੇੜੇ ਹੋਣ ਕਰਕੇ ਪਹਾੜਾਂ ਦੇ ਉੱਤੇ ਵੀ ਮੌਸਮ ਦਾ ਤਾਂ ਫਰਕ ਹੈਗਾ ਹੀ ਹਾਂਜੀ ਧੰਨਵਾਦ ਜੀ